ਹੈਲੋ ਹਾਂਜੀ ਫੋਟੋ ਵਾਸਤੇ ਹਾਂਜੀ ਹਾਂਜੀ ਫੋਟੋ ਵਾਸਤੇ ਕੀ ਸੀ ਮੈਰਿਜ 'ਤੇ ਮਤਲਬ ਕਿ ਕਿਵੇਂ ਨਾਲ ਲੋਕਸ਼ਨ ਵੀ ਨਾਲ ਤੁਸੀਂ ਕਰਨੀ ਹੈ ਕਵਰ ਹਾਂਜੀ ਜਿਵੇਂ ਹਾਂ ਹਰ ਸਟੈੱਪ 'ਤੇ ਮੰਨ ਲਓ ਜਿਵੇਂ ਆਨੰਦ ਕਾਰਜ ਨੇ ਅਤੇ ਤੁਸੀਂ ਗੁਰਦੁਆਰੇ ਦੀ ਵੀ ਸਾਰੀ ਉਵੇਂ ਸਾਇਡ ਸਾਰਾ ਕਵਰ ਹੋਵੇ ਹੈ ਨਾ ਚਲਦੇ ਹਰ ਸਟੈੱਪ ਜਿਵੇਂ ਲਾਵਾਂ ਹੀ ਨੇ ਹੁੰਦੀਆਂ ਪਈਆਂ ਜਾਂ ਕਿਵੇਂ ਆਉਂਦੇ ਪੂਰੀ ਉਵੇਂ ਡਰੈੱਸ ਪੂਰਾ ਹਰ ਚੀਜ਼ ਹੈ ਸਟੈੱਪ ਸਟੈੱਪ 'ਤੇ ਮਤਲਬ ਕਿ ਪੂਰਾ ਕਵਰ ਕਰਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਬਸ ਉਵੇਂ ਮਤਲਬ ਕਿ ਹਰ ਚੀਜ਼ ਜਿਵੇਂ ਪਹਿਲਾਂ ਆਪਾਂ ਘਰ ਤੋਂ ਹੀ ਸ਼ੁਰੂ ਕਰਾਂਗੇ ਮੰਦਰ ਗੁਰਦੁਆਰਾ ਜਾਂ ਮੰਦਰ ਹੈ ਘਰ ਦੇ ਵਿੱਚ ਵੀ ਜੋ ਬਣਿਆ ਜੋ ਆਪਣਾ ਸਥਾਨ ਉੱਥੇ ਫਿਰ ਪੂਰੇ ਹਾਊਸ ਦੀ ਉਵੇਂ ਲੋਕੇਸ਼ਨਸ ਬਾਹਰੋਂ ਉਵੇਂ ਸਾਰੀ ਡੈਕੋਰੇਸ਼ਨ ਦੀ ਸਾਰੀ ਹਾਂਜੀ ਸਾਰੀ ਉਵੇਂ ਦੀ ਉਵੇਂ ਆਉਣੀ ਚਾਹੀਦੀ ਬਾਕੀ ਹਰ ਚੀਜ਼ ਮਤਲਬ ਕਿ ਤੁਸੀਂ ਆਪ ਹੀ ਨਾਲ ਨਾਲ ਦੱਸਦੇ ਹੀ ਜਾਣਾ ਤੁਸੀਂ ਕਰਦੇ ਹੀ ਹੋ ਪਤਾ ਹੀ ਹੈ ਤੁਹਾਨੂੰ ਵੀ ਕਿਵੇਂ ਕਵਰ ਕਰਨਾ ਸਾਰਾ ਪੇਰੈਂਟਸ ਦਾ ਫਰੈਂਡ ਸਰਕਲ ਕਿਵੇਂ ਸਾਰਾ ਉਹ ਕਰਨਾ ਪੂਰਾ ਹੈ ਨਾ ਬਾਕੀ ਉੱਥੇ ਪੈਲਿਸ ਦੇ ਵਿੱਚ ਵੀ ਫੂਡ ਆਈਟਮਸ ਦਾ ਸਾਰਾ ਮਤਲਬ ਕਿ ਹਰ ਚੀਜ਼ ਕਵਰ ਹੋਣੀ ਚਾਹੀਦੀ ਆਪਣੇ ਵੀ ਇਹ ਪਿੱਛੇ ਛੁੱਟ ਗਿਆ ਆਹ ਰਹਿ ਗਿਆ ਹੈ ਨਾ ਬਾਕੀ ਸਟੇਜ਼ 'ਤੇ ਆਉਂਦਿਆਂ ਦੀ ਪੂਰੀ ਇਹ ਕਈ ਵਾਰੀ ਪਤਾ ਕੀ ਹੈ ਮੈਂ ਕਈ ਮੈਰਿਜ਼ ਵੀ ਦੇਖਿਆ ਕਿ ਪਹਿਲਾਂ ਲੈਂਦੇ ਲੈਂਦੇ ਬਰਾਈਟ ਦੀ ਅਤੇ ਫਿਰ ਕਿਤੇ ਹੋਰ ਕੈਮਰਾ ਹੈ ਨਾ ਉਹ ਨਹੀਂ ਮਤਲਬ ਕਿ ਉਹ ਜਿਹੜਾ ਪੂਰਾ ਉਹ ਸਟੈੱਪ ਖ਼ਤਮ ਜਿੰਨੀ ਦੇਰ ਤੱਕ ਨਹੀਂ ਹੋਵੇ ਕਮੈਰਾ ਉਨੀ ਉੱਥੋਂ ਨਹੀਂ ਪਾਸੇ ਹੋਣਾ ਚਾਹੀਦਾ ਪੂਰੀ ਲੋਕੇਸ਼ਨ ਹਰ ਚੀਜ਼ ਆਉਂਦਿਆਂ ਦੀ ਉੱਤੇ ਬੈਠਦਿਆਂ ਦੀ ਸਾਰੀ ਵੀ ਕੋਈ ਵੀ ਮੈਂ ਇਹ ਕਹਿੰਦੀ ਕਿ ਕੋਈ ਵੀ ਜਿਹੜੇ ਬਟ ਹੈਗੇ ਨੇ ਆਪਣੇ ਰਿਵਾਜ਼ ਜੇ ਕੋਈ ਵੀ ਵਿੱਚੋਂ ਮਤਲਬ ਕਿ ਮਿਸ ਨਹੀਂ ਹੋਣਾ ਚਾਹੀਦਾ ਹੈ ਨਾ ਵੀ ਆਹ ਰਹਿ ਗਿਆ ਬਣਨਾ ਇਹ ਇੱਧਰ ਹੋ ਗਿਆ ਜਾਂ ਆਹ ਹੋ ਗਿਆ ਹਰ ਚੀਜ਼ ਕਮਰ ਹੋਣੀ ਚਾਹੀਦੀ ਹੈ ਹਾਂਜੀ ਬਾਕੀ ਕੋਈ ਜਿਵੇਂ ਡਾਂਸ ਤਿਆਰ ਕੀਤੇ ਆ ਕਿਸੇ ਨੇ ਥੋੜ੍ਹਾ ਲਿਆ ਨਹੀਂ ਲਿਆ ਮਤਲਬ ਕਿ ਹ ਹਾਂਜੀ ਜਿਹੜੇ ਸਾਰਿਆਂ ਨੇ ਤਿਆਰ ਕੀਤੇ ਨੇ ਹਾਂਜੀ ਜਿਵੇਂ ਤਿਆਰ ਕੀਤੇ ਨੇ ਜੀ ਉਹ ਬਣਾਉਂਦੇ ਪਏ ਤਾਂ ਉਹ ਪੂਰਾ ਕਵਰ ਕਰਨਾ ਹੀ ਹੈ ਇਹ ਨਹੀਂ ਵੀ ਇੱਕ ਸਟੈੱਪ ਦਿਖਾਇਆ ਨਹੀਂ ਜਿਹੜਾ ਬਹੁਤ ਅੱਛਾ ਵਧੀਆ ਜਾਂ ਪੁੱਛ ਹੀ ਲੈਣ ਆਪਦਾ ਬੰਦਾ ਕਿ ਤੁਹਾਨੂੰ ਪਹਿਲੇ ਦੱਸ ਹੀ ਦਿਆਂਗੇ ਵੀ ਇਹਨਾਂ ਦਾ ਪੂਰਾ ਕਰਨਾ ਹੈ ਨਾ ਵਿੱਚੋਂ ਕੋਈ ਜਿਹੜਾ ਮਿਸ ਕਰਨਾ ਆ ਮਿਸ ਕਰਨਾ ਜਿਹੜਾ ਪੂਰਾ ਜਿਹਨੂੰ ਕਵਰ ਕਰਨਾ ਕਰਨਾ

ਬਾਕੀ ਡਰੈੱਸ ਦੀ ਵੀ ਜਿਵੇਂ ਆਪਾਂ ਫੋਟੋ ਲੈਂਦੇ ਬਰਾਈਟ ਦੀ ਲਈਏ ਡਰੈੱਸ ਵੀ ਪੂਰੀ ਐਂ ਇੱਕ ਇੱਕ ਚੀਜ਼ ਮਤਲਬ ਕਿ ਦਿਖੇ ਡਰੈੱਸ ਵਿੱਚ ਸਾਰਾ ਹੈ ਨਾ ਪੂਰਾ ਕਵਰ ਹੋਣਾ ਚਾਹੀਦਾ ਉਵੇਂ ਹੋਰ ਬਾਕੀ ਤੁਹਾਨੂੰ ਜ਼ਿਆਦਾ ਪਤਾ ਤੁਸੀਂ ਜਾਂਦੇ ਹੀ ਰਹਿੰਦੇ ਹੋ ਮੈਰਿਜਿਸ ਵੀ ਦੇਖਦੇ ਹੀ ਹੋ ਵੀ ਬਾਕੀ ਜਿਵੇਂ ਤੁਸੀਂ ਕਹੋਗੇ ਤੁਹਾਡੀਆਂ ਸੁਜਸ਼ਨਸ ਵੀ ਨਾਲ ਨਾਲ ਚੱਲਣਗੀਆਂ ਹੈ ਨਾ ਤੁਹਾਨੂੰ ਪਤਾ ਹੀ ਹੈ ਕਿਉਂਕਿ ਤੁਹਾਡਾ ਕੰਮ ਹੀ ਇਹ ਹੈ ਅਸੀਂ ਤਾਂ ਦੱਸ ਦਿਆਂਗੇ ਆਹ ਕਵਰ ਕਰਨਾ ਆ ਕਵਰ ਕਰਨਾ ਕਿਵੇਂ ਕਰਨਾ ਇਹ ਤੁਹਾਨੂੰ ਜ਼ਿਆਦਾ ਬੈਟਰ ਪਤਾ ਸਾਡੇ ਨਾਲੋਂ ਵੀ ਹੈ ਨਾ ਕਿਉਂਕਿ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਹੈ ਸਾਡਾ ਤਾਂ ਕਦੇ ਕਦੇ ਵਾਹ ਪੈਂਦਾ ਤੁਹਾਡਾ ਤਾਂ ਰੋਜ਼ ਹਮੇਸ਼ਾ ਹੀ ਤੁਸੀਂ ਜ਼ਿਆਦਾ ਇਹਨਾਂ ਸੁਚੇਸ਼ਨ ਨੂੰ ਹੈਂਡਲ ਕਰਦੇ ਹੀ ਹੋ ਹੈ ਨਾ ਠੀਕ ਹੈ ਬਾਕੀ ਤੁਹਾਡੇ 'ਤੇ ਪੂਰਾ ਵਿਸ਼ਵਾਸ ਕੀਤਾ ਉਮੀਦ ਹੈ ਕਿ ਤੁਸੀਂ ਵਧੀਆ ਹੀ ਕਰੋਗੇ ਸਭ ਕੁਛ ਨਾਮ ਤੁਹਾਡਾ ਚੰਗਾ ਹੈ ਨਾ ਇਸ ਫੀਲਡ ਦੇ ਵਿੱਚ ਦੇ ਵਿੱਚ ਚਲੋ ਠੀਕ ਹੈ ਜੀ ਥੈਂਕ ਯੂ ਜੀ